ਸੱਤ ਫਰਵਰੀ ਦੋ ਹਜ਼ਾਰ ਪੰਜ ਗਿਆਰਾਂ ਫਰਵਰੀ ਉੱਨੀ ਸੌ ਪੰਝੱਤਰ ਦੋ ਜਨਵਰੀ ਉੱਨੀ ਸੌ ਚੁਹੱਤਰ ਉੱਨੀ ਜਨਵਰੀ ਦੋ ਹਜ਼ਾਰ ਵੀਹ ਦੋ ਅਕਤੂਬਰ ਅਠਾਰਾਂ ਸੌ ਉਣੱਤਰ